ਮੈਂ ਵਰਿੰਦਰ ਕੁਮਾਰ ਜ਼ਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਹਾਂ ਮੈਂ ਲਿਖਣ ਦਾ ਕੰਮ ਸ਼੍ਰੀ ਲੇਖ ਰਾਜ ਜੀ ਤੋਂ ਸਿੱਖਿਆ ਉਹ ਇੱਕ ਬੜੇ ਹੀ ਵਧੀਆ ਲੇਖਕ ਹਨ

ਉਰਦੂ ਪੰਜਾਬੀ ਅਤੇ ਹਿੰਦੀ ਤਿੰਨਾਂ ਭਾਸ਼ਾਵਾਂ ਵਿੱਚ ਲਿਖਦੇ ਹਨ ਉਹਨਾਂ ਨੇ ਆਪਣੇ ਅਧਿਆਪਕ ਦੇ ਨਾਲ ਨਾਲ ਉਹਨਾਂ ਨੇ ਐਮ ਏ ਪੰਜਾਬੀ ਐਮ ਏ ਇੰਗਲਿਸ਼ ਅਤੇ ਐਮ ਏ ਉਰਦੂ ਦੀ ਕੀਤੀ

ਬੁਲੰਦੀਆਂ ਨੂੰ ਛੂਹਿਆ ਮੈਨੂੰ ਜਦੋਂ ਵੀ ਉਹਨਾਂ ਦੇ ਕੋਲ ਜਾਣ ਦਾ ਮੌਕਾ ਮਿਲਦਾ ਹੈ ਅਸੀਂ ਉਹਨਾਂ ਦੀ ਰਹਿਨੁਮਾਈ ਹੇਠ ਉਹਨਾਂ ਕੋਲ ਕੁਝ ਸਿੱਖਦੇ ਹਾਂ

ਉਨ੍ਹਾਂ ਨੇ ਐਮ ਏ ਕਰਨ ਤੋਂ ਬਾਅਦ ਪੀ ਐਚ ਡੀ ਕੀਤੀ ਅਤੇ ਆਪਣੇ ਨਾਂ ਦੇ ਨਾਲ ਡਾਕਟਰ ਸ਼ਬਦ ਨੂੰ ਜੋੜਿਆ ਉਹ ਗਜ਼ਲਾਂ ਕਵਿਤਾਵਾਂ ਅਤੇ ਸਾਹਿਤ ਬਾਰੇ ਵੀ ਲਿਖਦੇ ਹਨ ਉਹ ਇੱਕ ਉਹਨਾਂ ਦੀ ਲਿਖਣ ਦੀ ਵਿੱਚ ਰੂਹਾਨੀਅਤ ਜਾਪਦੀ ਹੈ ਜੋ ਉਹਨਾਂ ਦੇ ਲੇਖ ਨੂੰ ਨੂੰ ਪੜ੍ਹਦਾ ਹੈ ਉਹ ਵੀ ਉਹਨਾਂ ਦੇ ਰੰਗ ਉਸੇ ਰੰਗ ਵਿੱਚ ਰੰਗਿਆ ਜਾਂਦਾ ਹੈ ਸਾਨੂੰ ਉਹਨਾਂ ਤੋਂ ਬਹੁਤ ਕੁਛ ਸਿੱਖਣ ਦਾ ਮੌਕਾ ਮਿਲਦਾ ਹੈ ਅਸੀਂ ਉਹਨਾਂ ਦੇ ਤੋਂ ਪ੍ਰਭਾਵਿਤ ਹੋ ਕੇ ਅਸੀਂ ਵੀ ਲਿਖਣਾ ਜਿਹੜਾ ਸ਼ੁਰੂ ਕੀਤਾ ਹੈ